ਮੇਰੇ ਇਲਾਕੇ ਦੇ ਬਹੁਤ ਸਾਰੇ ਕੋਲਜ ਜਿਵੇਂ ਰਿਆਤ ਬਾਰਿਆ ਦੁਆਬਾ ਕੋਲਜ ਆਈ ਟੀ ਭੱਦਲ਼ ਅਤੇ ਪੰਜਾਬ ਯੂਨੀਵਰਸਿਟੀ ਅਤੇ ਛੇ ਫੇਸ ਦੇ ਲਾਗੇ ਇੱਕ ਹੋਰ ਕੋਲਜ ਹੈ ਜਿਸ ਵਿੱਚ ਮੇਰੇ ਨਾਲ਼ ਦੇ ਨੌਜਵਾਨ ਉੱਥੇ ਹੀ ਪੜ੍ਹਦੇ ਹਨ ਜੋ ਕਿ ਅਲੱਗ ਅਲੱਗ ਕੋਰਸ ਕਰਦੇ ਹਨ ਜਿਵੇਂ ਕਿ ਬੀ ਏ ਬੀ ਟੈੱਕ ਐੱਮ ਬੀ ਏ ਐੱਮ ਐੱਸ ਸੀ ਆਦਿ ਕੋਰਸ ਕਰਦੇ ਹਨ